ਮੇਰੇ ਘਰ ਪਰਿਵਾਰ ਦੇ ਮੈਂਬਰਾਂ ਵਿੱਚ ਅਸੀਂ ਮੇਰੇ ਮੰਮੀ ਪਾਪਾ ਮੇਰਾ ਭਰਾ ਅਤੇ ਮੈਂ ਖੁਦ ਹਾਂ ਸਾਡੀ ਪਰਿਵਾਰ ਬਹੁਤ ਹੀ ਛੋਟਾ ਪਰਿਵਾਰ ਹੈ ਅਤੇ ਅਸੀਂ ਚਾਰੇ ਹੀ ਰਹਿੰਦੇ ਹਾਂ ਅਤੇ ਇਸ ਤੋਂ ਇਲਾਵਾ ਮੇਰੇ ਦੋਸਤਾਂ ਦੇ ਵਿੱਚ ਮੇਰੇ ਬਹੁਤ ਸਾਰੇ ਫਰੈਂਡਸ ਆ ਜਾਂਦੇ ਨੇ ਜਿਵੇਂ ਸਕੂਲ ਫਰੈਂਡਸ ਕੋਲਜ ਫਰੈਂਡਸ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫਰੈਂਡਸ ਜੋ ਆਪਣੇ ਨਾਲ਼ ਚੱਲ ਰਹੇ ਹੁੰਦੇ ਨੇ ਅਤੇ ਇਸ ਜੇ ਕਲੋਜ ਫਰੈਂਡਸ ਦੀ ਗੱਲ ਕਰੀਏ ਤਾਂ ਤਿੰਨ ਤੋਂ ਚਾਰ ਫਰੈਂਡਸ ਹੀ ਮੇਰੇ ਬਹੁਤ ਕਲੋਜ ਨੇ ਅਤੇ ਬਾਕੀ ਸਾਰੇ ਆਪਣੇ ਨੋਰਮਲੀ ਫਰੈਂਡਸ ਆ ਜਾਂਦੇ ਨੇ ਜਿਵੇਂ ਕਲਾਸਮੇਟਸ ਹੋ ਗਏ ਸਕੂਲ ਫਰੈਂਡਸ ਹੋ ਗਏ ਜਾਂ ਆਂਢ ਗੁਆਂਢ ਦੇ ਵਿੱਚ ਹੋ ਗਏ ਉਹ ਫਰੈਂਡਸ